ਰੋਜ਼ ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਅਤੇ ਬਰਸਾਤੀ ਰਹਿੰਦਾ ਹੈ ਅਤੇ ਬਰਸਾਤਾਂ ਦੇ ਮੌਸਮ ਵਿੱਚ ਕਾਫ਼ੀ ਮੀਂਹ ਮੀਂਹ ਜ਼ਿਆਦਾ ਪੈਂਦੇ ਹਨ ਅਤੇ ਇਸ ਨਾਲ ਮੀਂਹ ਜ਼ਿਆਦਾ ਪੈਣ ਕਰਕੇ ਇੱਥੇ ਹੜ੍ਹ ਆ ਜਾਂਦੇ ਹਨ ਅਤੇ ਉੱਨੀ ਸੌ ਤਿਰਾਨਵੇਂ ਵਿੱਚ ਵੀ ਹੜ੍ਹ ਆਇਆ ਸੀ ਅਤੇ ਹੁਣ ਦੋ ਹਜ਼ਾਰ ਤੇਈ ਵਿੱਚ ਵੀ ਗਿਆਰਾਂ ਜੁਲਾਈ ਨੂੰ ਹੜ੍ਹ ਆਇਆ ਅਤੇ ਲੋਕਾਂ ਦਾ ਜੀਵਨ ਅ ਅਸਤ ਵਿਅਸਤ ਹੋ ਗਿਆ ਜਿਸਦੇ ਨਾਲ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਮ ਸ ਫਸਲਾਂ ਵਿੱਚ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਅਤੇ ਪਹਾੜੀ ਇਲਾਕੇ ਹੋਣ ਕਰ ਪਹਾੜੀ ਇਲਾਕੇ ਹੋਣ ਕਰਕੇ ਇੱਥੇ ਉੱਪਰੋਂ ਬਰਸਾਤ ਜ਼ਿਆਦਾ ਪੈਣ ਕਰਕੇ ਇੱਥੇ ਪਾਣੀ ਦਰਿਆਵਾਂ ਵਿੱਚ ਭਰ ਜਾਂਦਾ ਹੈ ਅਤੇ ਸ਼ਹਿਰ ਡਗੋਂ ਡੱਗ ਪਾਣੀ ਨਾਲ ਭਰ ਜਾਂਦਾ ਹੈ ਅਤੇ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਸ ਨਾਲ ਕਿ ਲੋਕਾਂ ਦੇ ਸਮਾਨ ਵਗੈਰਾ ਹੜ੍ਹ ਜਾਂਦੇ ਹਨ ਪਾਣੀ ਵਿੱਚ ਤਾਂ ਸਰਕਾਰਾਂ ਵੀ ਨੇੜੇ ਨਹੀਂ ਖੜ੍ਹਦੀਆਂ ਅਤੇ ਲੋਕਾਂ ਨੂੰ ਬਹੁਤ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ